ਹੈਲੋ ਹਾਂਜੀ ਆਟੋ ਰਿਕਸ਼ਾ ਦੀ ਕੰਪਨੀ ਤੋਂ ਬੋਲ ਰਹੇ ਹੋ ਜੀ ਮੈਮ ਅਸੀਂ ਆਟੋ ਰਿਕਸ਼ਾ ਨਾ ਕਿਰਾਏ 'ਤੇ ਕਰਨਾ ਸੀ ਮੈਮ ਅਸੀਂ ਨਾ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਸੀ ਅਤੇ ਆਪਣੇ ਕੋਲ ਆਟੋ ਹੀ ਹੈ ਜਾਂ ਫਿਰ ਟੈਕਸੀ ਵਗੈਰਾ ਦਾ ਵੀ ਹੈਗਾ ਆ ਠੀਕ ਹੈ ਮੈਮ ਜੀ ਸਾਨੂੰ ਨਾ ਟੈਕਸੀ ਚਾਹੀਦੀ ਸੀ ਹੈਵੀ ਅਤੇ ਅਸੀਂ ਮਤਲਬ ਪੰਜ ਕੁ ਸਵਾਰੀਆਂ ਬਣ ਜਾਵਾਂਗੇ ਅਤੇ ਸਮਾਨ ਵੀ ਹੋਏਗਾ ਅਤੇ ਇੱਕ ਟੈਕਸੀ 'ਚ ਸਹੀ ਮਤਲਬ ਹੋ ਜਾਵੇਗਾ ਅਰੇਂਜਮੈਂਟ ਠੀਕ ਹੈ ਅਸੀਂ ਦਸ ਕੁ ਦਿਨ 'ਤੇ ਹੀ ਜਾਣਾ ਅਤੇ ਉੱਥੇ ਮਤਲਬ ਸਾਨੂੰ ਘੁੰਮਣ ਫਿਰਨ ਦਾ ਵੀ ਹੈਗਾ ਨਾ ਸਾਰਾ ਵਿੱਚ ਪਾ ਕੇ ਤੁਸੀਂ ਦੱਸਿਓ ਠੀਕ ਹੈ ਜੀ ਠੀਕ ਹੈ ਜੀ ਹੋਰ ਅਸੀਂ ਪੁੱਛਣਾ ਸੀ ਵੀ ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਅਗਰ ਹਾਂਜੀ ਅੱਗੇ ਵੀ ਮਤਲਬ ਜਿੱਦਾਂ ਕੋਈ ਹੁੰਦਾ ਆ ਅੱਗੇ ਦਾ ਟੂਰ ਤਾਂ ਫੇਰ ਤੁਹਾਡੇ ਨਾਲ ਸੰਪਰਕ ਕਰ ਸਕਦੇ ਅਸੀਂ ਹਾਂਜੀ ਸਾਰਾ ਦੱਸ ਦੇਵਾਂਗੇ ਜੀ ਅਸੀਂ ਤੁਹਾਡੇ ਵੱਲ ਹਾਂਜੀ ਅਤੇ ਹੋਰ ਪੁੱਛਣਾ ਸੀ ਜੀ ਆਪਣਾ ਇਕੱਲਾ ਹੀ ਕਿਰਾਇਆ ਆਉਣ ਜਾਣ ਦਾ ਕਿ ਵਿੱਚ ਹੋਰ ਵੀ ਕੋਈ ਤੁਸੀਂ ਸਾਨੂੰ ਕਰੋਗੇ ਕੋਈ ਉਹ ਅਲੱਗ ਤੋਂ ਨਹੀਂ ਮੈਂ ਕਿਹਾ ਜੀ ਅਗਰ ਤੁਸੀਂ ਉੱਥੋਂ ਦੇ ਕਿਸੇ ਹੋਟਲ ਵਾਲਿਆਂ ਨਾਲ ਗੱਲ ਕਰ ਲੈਂਦੇ ਅਤੇ ਸਾਨੂੰ ਰਹਿਣ ਦਾ ਵੀ ਤੁਸੀਂ ਕਰ ਦਿੰਦੇ ਤਾਂ ਹਾਂਜੀ ਹਾਂਜੀ ਏਦਾਂ ਨਾ ਫੇਰ ਉੱਥੇ ਘੁੰਮਣ ਵਾਸਤੇ ਅਲੱਗ ਅਲੱਗ ਜਗ੍ਹਾ 'ਤੇ ਫੇਰ ਉੱਥੇ ਵਧੀਆ ਲੋਕੇਸ਼ਨ ਹੋਵੇ ਨਾ ਠੀਕ ਹੈ ਜੀ ਹਾਂ ਏ ਸੀ ਵਧੀਆ ਗੱਡੀ ਹੋਣੀ ਚਾਹੀਦੀ ਹੈ

ਹਾਂਜੀ ਏਦਾਂ ਨਾ ਫੇਰ ਐਨਾ ਟੈਮ ਬੈਠ ਕੇ ਨਹੀਂ ਜਾਇਆ ਜਾ ਸਕਦਾ ਨਾ ਅਰਾਮ ਨਾਲ ਠੀਕ ਹੈ ਜੀ ਥੈਂਕ ਯੂ